ਮੈਨੂੰ ਮੇਰੇ ਪਰਿਵਾਰ ਨਾਲ ਬਹੁਤ ਪਿਆਰ ਹੈ ਮੈਂ ਪਰਿਵਾਰ ਮੇਰਾ ਪਰਿਵਾਰ ਇਕੱਠਾ ਰਹਿੰਦਾ ਹੈ ਸਾਡੀ ਜੁਆਇੰਟ ਫੈਮਿਲੀ ਹੈ ਮੈਨੂੰ ਮੇਰਾ ਪਰਿਵਾਰ ਬਹੁਤ ਪਿਆਰ ਕਰਦਾ ਹੈ ਕੋਈ ਵੀ ਇੱਕ ਦੂਜੇ ਨਾਲ ਗਿਲਾ ਸ਼ਿਕਵਾ ਨਹੀਂ ਰੱਖਦਾ ਇੱਕ ਦੂਜੇ ਨੂੰ ਪਿਆਰ ਮੁਹੱਬਤ ਕਰਦੇ ਹਨ ਅਤੇ ਮੁਸੀਬਤ ਹੋਣ 'ਤੇ ਮੋਢੇ ਨਾਲ ਮੋਢਾ ਖੜ੍ਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਂਦੇ ਹਨ ਮੇਰੇ ਪਰਿਵਾਰ ਵਿੱਚ ਮੇਰੇ ਪਾਪਾ ਮੇਰੇ ਮੰਮਾ ਅਤੇ ਮੇਰਾ ਭਰਾ ਅਤੇ ਦੋ ਭੈਣਾਂ ਹਨ ਭੈਣਾਂ ਮੇਰੀ ਮੇਰੀਆਂ ਦੋ ਭੈਣਾਂ ਦੀ ਮੈਰਿਜ ਹੋ ਚੁੱਕੀ ਹੈ ਅਤੇ ਉਹ ਆਪਣੇ ਸਹੁਰੇ ਪਰਿਵਾਰ ਬਹੁਤ ਵਧੀਆ ਹਨ ਅਤੇ ਮੇਰੇ ਪਰਿਵਾਰ ਵਿੱਚ ਇੱਕ ਤਾਇਆ ਅਤੇ ਤਾਈ ਜੀ ਅਤੇ ਉਹਨਾਂ ਦੇ ਬੱਚੇ ਸਾਡੇ ਨਾਲ ਰਹਿੰਦੇ ਹਨ ਮੇਰਾ ਇੱਕ ਭਤੀਜਾ ਅਤੇ ਭਤੀਜੀ ਹੈ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਜਦੋਂ ਅਸੀਂ ਕਿਸੇ ਵੀ ਜਗ੍ਹਾ 'ਤੇ ਘੁੰਮਣ ਜਾਂਦੇ ਹਾਂ ਸਾਡਾ ਪਰਿਵਾਰ ਇਕੱਠਾ ਇਕੱਠੇ ਘੁੰਮਣ ਜਾਂਦੇ ਹਾਂ ਅਸੀਂ ਬਹੁਤ ਮਸਤੀ ਕਰਦੇ ਹਾਂ ਅਤੇ ਹਾਸਾ ਮਜ਼ਾਕ ਕਰਦੇ ਹਾਂ ਹੁਣ ਮੈਂ ਆਪਣੇ ਦੋਸਤਾਂ ਬਾਰੇ ਗੱਲ ਕਰਨ ਲੱਗੀ ਹਾਂ ਵੈਸੇ ਤਾਂ ਮੇਰੇ ਸਾਰੇ ਹੀ ਦੋਸਤ ਬਹੁਤ ਵਧੀਆ ਹਨ ਪਰ ਰਣਪ੍ਰੀਤ ਮੇਰੀ ਬੈਸਟ ਫਰੈਂਡ ਬੈਸਟ ਫਰੈਂਡ ਹੈ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਮੈਂ ਸਾਰੀ ਗੱਲ ਉਹਨਾਂ ਨਾਲ ਸ਼ੇਅਰ ਕਰਦੀ ਹਾਂ ਅਤੇ ਉਹ ਮੁਸੀਬਤ ਵਿੱਚ ਮੇਰਾ ਪੂਰਾ ਸਾਥ ਦਿੰਦੇ ਹਨ ਜੇਕਰ ਅਸੀਂ ਕਿਸੇ ਜਗ੍ਹਾ 'ਤੇ ਘੁੰਮਣ ਜਾਣਾ ਹੋਵੇ ਅਸੀਂ ਇਕੱਠੇ ਘੁੰਮਣ ਜਾਂਦੇ ਹਾਂ ਅਤੇ ਪੜ੍ਹਾਈ ਰਿਲੇਟਡ ਕੋਈ ਵੀ ਕੁਸ਼ਚਨ ਮੈਨੂੰ ਸਮਝਣ ਨਹੀਂ ਆਉਂਦਾ ਅਤੇ ਉਹ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਅਤੇ ਜੇਕਰ ਕੋਈ ਅਸੀਂ ਚੀਜ਼ ਖਰੀਦਣੀ ਹੋਵੇ ਅਸੀਂ ਇੱਕ ਸਾਰ ਦੀ ਇਕੱਠੀ ਚੀਜ਼ ਲੈਂਦੇ ਹਾਂ ਅਤੇ ਉਹਨਾਂ ਦੀ ਫੈਮਲੀ ਵੀ ਬਹੁਤ ਮੈਨੂੰ ਪਿਆਰ ਕਰਦੀ ਹੈ